ਸਾਡੇ ਖੇਤਰ ਦੇ ਸਟੇਡੀਅਮ ਅਰੀਨਾਸ ਗਰਾਉਂਡ ਅਤੇ ਖੇਡ ਸਮਾਗਮ ਕਰਵਾਉਣ ਲਈ ਬਹੁਤ ਸਹੂਲਤਾਂ ਉਪਲਬਧ ਹਨ ਜਿਵੇਂ ਓਡੀਟੋਰੀਅਮ ਅਤੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਗਰਾਊਂਡ ਵਿੱਚ ਵੀ ਬਹੁਤ ਸਫਾਈ ਹੁੰਦੀ ਹੈ ਸੈਟਿੰਗ ਅਰੇਜਮੈਂਟ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੁੰਦਾ ਹੈ ਸਟੇਰਸ ਦੇ ਉੱਤੇ ਵੀ ਬਹੁਤ ਸਫਾਈ ਹੁੰਦੀ ਹੈ ਤਾਂ ਜੋ ਸਾਰੇ ਦੇਖਣ ਵਾਲੇ ਉੱਥੇ ਬੈਠ ਸਕਣ ਇਸ ਤੋਂ ਇਲਾਵਾ ਉੱਥੇ ਛਾਂ ਦੀ ਵੀ ਬਹੁਤ ਵਧੀਆ ਉਪਲਬਧਤਾ ਹੈ ਅਤੇ ਕੋਚ ਨਿਰਪੱਖ ਫੈਸਲੇ ਲੈਣ ਵਾਲਾ ਹੁੰਦਾ ਹੈ ਅਤੇ ਵਧੀਆ ਟ੍ਰੇਨਿੰਗ ਫੀਡਬੈਕ ਅਤੇ ਉਹਨਾਂ ਦੀ ਮੀਲ ਬਹੁਤ ਵਧੀਆ ਹੁੰਦੀ ਹੈ